ਸਾਡੇ ਸੱਭਿਆਚਾਰ ਵਿੱਚ ਮੁੱਖ ਕਿੱਤਾ ਖੇਤੀਬਾੜੀ ਹੈ ਖੇਤੀਬਾੜੀ ਨੂੰ ਛੱਡ ਕੇ ਲੋਕਾਂ ਦਾ ਬਾਹਰ ਚਲੇ ਜਾਣਾ ਇਸ ਮੁੱਖ ਇਸ ਦਾ ਮੁੱਖ ਕਾਰਨ ਹੈ ਉਹਨਾਂ ਦੇ ਬਾਹਰ ਜਾਣ ਦਾ ਕਿ ਜਿਸ ਤਰ੍ਹਾਂ ਫਸਲਾਂ ਦੀ ਕਾਸ਼ਤ ਕਰਨ 'ਤੇ ਫਸਲਾਂ ਦੀ ਪੈਦਾਵਾਰ ਕਰਨ 'ਤੇ ਖਰਚਾ ਜ਼ਿਆਦਾ ਆਉਂਦਾ ਹੈ ਉਸ ਤੋਂ ਬਾਅਦ ਫਸਲ ਨੂੰ ਫਸਲ ਨੂੰ ਜਦੋਂ ਵੇਚਣ ਜਾਂਦਾ ਹੈ ਕਿਸਾਨ ਅਤੇ ਉਸ ਦੀ ਪੂਰੀ ਉਹਦਾ ਜਿਹੜੀ ਖਰਚੇ ਦੀ ਹੀ ਪੂਰਤੀ ਹੁੰਦੀ ਹੈ ਉਹ ਹੀ ਨਹੀਂ ਪੂਰੀ ਹੁੰਦੀ ਜਾਣੀ ਕਿ ਉਹਨਾਂ ਦਾ ਰੇਟ ਨਾ ਸਹੀ ਲੱਗਣ 'ਤੇ ਉਹਨਾਂ ਨੂੰ ਪੂਰਾ ਰੇਟ ਨਹੀਂ ਮਿਲਦਾ ਹੈ ਅਤੇ ਆਮਦਨ ਹੁੰਦੀ ਨਹੀਂ ਹੈ ਇਸ ਕਰਕੇ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਜਦੋਂ ਕਿਸਾਨ ਨੂੰ ਮੂੰਹ ਮੰਗਿਆ ਰੇਟ ਆਪਣੀ ਫਸਲ ਦਾ ਨਹੀਂ ਮਿਲਦਾ ਇਸ ਕਰਕੇ ਖੇਤੀਬਾੜੀ ਨੂੰ ਛੱਡ ਕੇ ਜਿਹੜੇ ਆ ਨੌਜਵਾਨ ਅੱਜ ਕੱਲ੍ਹ ਦੇ ਉਹ ਬਾਹਰ ਜਾ ਕੇ ਪ੍ਰਦੇਸ਼ਾਂ ਵਿੱਚ ਕੰਮ ਕਰਦੇ ਨੇ ਬਾਹਰ ਜਾ ਕੇ ਮਿਹਨਤ ਕਰਦੇ ਨੇ ਕਿਉਂਕਿ ਇੱਥੇ ਉਹਨਾਂ ਨੂੰ ਉਹਨਾਂ ਦੀ ਫਸਲਾਂ ਦੇ ਰੇਟ ਸਹੀ ਨਹੀਂ ਮਿਲ ਰਹੇ ਜਿੰਨਾ ਉਹਨਾਂ 'ਤੇ ਖਰਚਾ ਆਉਂਦਾ ਹੈ ਦਵਾਈਆਂ ਮਹਿੰਗੀਆਂ ਨੇ ਕੀਟਨਾਸ਼ਕ ਦਵਾਈਆਂ ਜ਼ਿਆਦਾ ਮਹਿੰਗੀਆਂ ਨੇ ਸਪਰੇਆਂ ਜ਼ਿਆਦਾ ਹੁੰਦੀਆਂ ਨੇ ਇਸ ਕਰਕੇ ਉਹਨਾਂ ਨੂੰ ਉਹਨਾਂ ਦੀ ਆਮਦਨ ਨਹੀਂ ਪੂਰਾ ਹੁੰਦਾ ਇਸ ਕਰਕੇ ਲੋਕ ਜੋ ਨੇ ਉਹ ਬਾਹਰ ਚਲੇ ਜਾਂਦੇ ਹਨ